ਜਿਵੇਂ ਕਿ ਤੁਸੀਂ ਮੈਨੂੰ ਪੁੱਛਿਆ ਹੈ ਪੰਜ ਜਿਲਿਆਂ ਦੇ ਨਾਮ ਪਹਿਲਾ ਮਾਨਸਾ ਸੰਗਰੂਰ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਬਰਨਾਲਾ ਇਹ ਪੰਜ ਜ਼ਿਲ੍ਹੇ ਹਨ